ਹਾਂਜੀ ਮੈਨੁੂੰ ਇਲੈਕਟ੍ਰੋਨਿਕ ਸੰਸਕਰਣਾਂ ਅਤੇ ਭੌਤਿਕ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਮੈਂ ਯਾਤਰਾ ਕਰਦੇ ਸਮੇਂ ਰਸੋਈ ਘਰ ਵਿੱਚ ਜਾਂ ਫਿਰ ਸਫਾਈ ਕਰਦੇ ਸਮੇਂ ਹੈੱਡਫੋਨ ਦੀ ਮਦਦ ਨਾਲ ਭੌਤਿਕ ਕਿਤਾਬਾਂ ਤੋਂ ਜਾਣਕਾਰੀ ਹਾਸਲ ਕਰਦੀ ਰਹਿੰਦੀ ਹਾਂ ਮੈਂ ਬਹੁਤ ਵਾਰ ਯੂਟਿਊਬ ਤੋਂ ਵੀਡਿਓ ਲੈਕਚਰ ਸੁਣ ਕੇ ਗਿਆਨ ਹਾਸਲ ਕਰਦੀ ਹਾਂ ਇਸ ਤਰ੍ਹਾਂ ਭੌਤਿਕ ਕਿਤਾਬਾਂ ਅਤੇ ਇਲੈਕਟ੍ਰੋਨਿਕ ਸੰਸਕਰਣਾਂ ਨੂੰ ਪੜ੍ਹਨਾ ਅਤੇ ਪਸੰਦ ਕਰਨਾ ਮੇਰੀ ਆਦਤ ਬਣ ਚੁੱਕੀ ਹੈ